ਮੇਰੇ ਅਨੁਸਾਰ ਭੰਗੜਾ ਐਰੋਬਿਕਸ ਮਾਨਸਿਕ ਅਤੇ ਮਾਨਸਿਕ ਸਿਹਤ ਭਾਵਨਾਤਮਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦਾ ਇੱਕ ਇੱਕ ਬਹੁਤ ਵਧੀਆ ਸਾਧਨ ਵਰਤਿਆ ਜਾ ਸਕਦਾ ਹੈ ਜਿਵੇਂ ਕਿ ਮਾਨਸਿਕ ਤੌਰ 'ਤੇ ਬੰਦਾ ਭੰਗੜਾ ਕਰਨ ਨਾਲ ਬਹੁਤ ਹੀ ਠੀਕ ਰਹਿੰਦਾ ਹੈ ਜਦੋਂ ਕਿ ਉਹ ਭੰਗੜਾ ਕਰਦਾ ਹੈ ਉਹ ਆਪਣੀ ਸਿਹਤ ਨੂੰ ਵੀ ਠੀਕ ਰੱਖ ਸਕਦਾ ਹੈ ਜੋ ਕਿ ਇੱਕ ਕਸਰਤ ਵਜੋਂ ਵੀ ਹੁੰਦਾ ਹੈ ਜਿਵੇਂ ਕਿ ਅਲੱਗ ਅਲੱਗ ਤਰ੍ਹਾਂ ਦੇ ਡਾਂਸ ਕਰਨੇ ਭੰਗੜਾ ਕਰਨਾ ਵੀ ਆਪਣੀਆਂ ਲੱਤਾਂ ਬਾਹਾਂ ਮਾਰਨ ਵਿੱਚ ਉਹ ਆਪਣਾ ਮੋਟਾਪਾ ਘੱਟ ਕਰ ਸਕਦਾ ਹੈ ਜਿਹਦੇ ਨਾਲ ਉਹ ਆਪਦੀ ਬੋਡੀ ਨੂੰ ਚੁਸਤ ਫਰੁਸਤ ਅਤੇ ਤੰਦਰੁਸਤ ਰੱਖ ਸਕਦਾ ਹੈ ਅਤੇ ਭਾਵਨਾਤਮਕ ਤੌਰ 'ਤੇ ਬਹੁਤ ਲੋਕਾਂ ਨੂੰ ਡਾਂਸ ਕਰਕੇ ਭੰਗੜਾ ਐਰੋਵਿਕਸ ਕਰਕੇ ਬਹੁਤ ਹੀ ਖੁਸ਼ੀ ਮਿਲਦੀ ਹੈ ਕਿ ਉਹ ਕਈ ਵਾਰ ਉਹ ਆਪਣੀਆਂ ਗੱਲਾਂ ਬੋਲ ਕੇ ਨਹੀਂ ਦੱਸ ਸਕਦੇ ਜੋ ਕਿ ਭਾਵਨਾਵਾਂ ਉਹ ਆਪਣੀਆਂ ਡਾਂਸ ਕਰਕੇ ਇੱਕ ਦੂਜੇ ਨੂੰ ਦਰਸਾ ਸਕਦੇ ਹਨ ਦੱਸ ਸਕਦੇ ਹਨ ਕਿ ਉਹ ਕਿ ਉਹਨਾਂ ਦੀਆਂ ਭਾਵਨਾਵਾਂ ਕੀ ਹੈ ਤੋ ਉਹ ਕਿਸੇ ਬਾਰੇ ਜਾਂ ਕਿਸੇ ਸਥਿਤੀ ਬਾਰੇ ਕੀ ਭਾਵ ਕਰਦੇ ਹਨ ਇਸ ਲਈ ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਲਈ ਭੰਗੜਾ ਕਰਨਾ ਬਹੁਤ ਜ਼ਰੂਰੀ ਹੈ ਜਿਸ ਲਈ ਅੱਜ ਬਹੁਤ ਹੀ ਉਹ ਨੌਜਵਾਨ ਇਹ ਕਰਦੇ ਵੀ ਹਨ ਜਿਵੇਂ ਇਸ ਲਈ ਕਰਦੇ ਹਨ ਕਿ ਉਹ ਆਪਣੇ ਵੇਟ ਨੂੰ ਬਿਲਕੁਲ ਠੀਕ ਰੱਖਣ ਅਤੇ ਆਪਣਾ ਮਾਇੰਡ ਰਿਲੈਕਸ ਰੱਖਣ ਟੈਂਸਨ ਸਟਰੈਸ ਫਰੀ ਰੱਖਣ ਕਿ ਉਹ ਆਪਣੀ ਆਦਤਾਂ ਗਲਤ ਗਲਤ ਪਾਸੇ ਨਾ ਲਿਜਾ ਸਕਣ ਜਿਵੇਂ ਕਿ ਨਸ਼ਿਆਂ ਵੱਲ ਕਿਉਂਕਿ ਭੰਗੜਾ ਕਰਨ ਨਾਲ ਉਹ ਆਪਣਾ ਫਿਊਚਰ ਵੀ ਸਕਿਓਰ ਕਰ ਸਕਦੇ ਹਨ ਕੋਰੀਓਗਰਾਫਰ ਬਣ ਕੇ ਜੋ ਕਿ ਉਹਨਾਂ ਦੇ ਮਨ ਦੀਆਂ ਭਾਵਨਾਵਾਂ ਦਰਸਾਉਂਦਾ ਹੈ ਅਤੇ ਕਸਰਤ ਵਿੱਚ ਉਹਨਾਂ ਦੀ ਸਿਹਤ ਰੱਖਣ ਸਿਹਤ ਨੂੰ ਠੀਕ ਰੱਖਣ ਦੇ ਵਿੱਚ ਬਹੁਤ ਮਦਦਗਾਰ ਹੁੰਦਾ ਹੈ